ਹਾਂਜੀ ਮੈਂ ਇੱਕ ਇਹੀ ਕਿਤਾਬਾਂ ਜ਼ਿਆਦਾ ਪੜ੍ਹਦੀ ਐਂ ਜਿਹੜਾ ਕਿ ਉੱਚੀ ਉੱਚੀ ਹੱਸਣ ਲਈ ਮਜ਼ਬੂਰ ਕਰਦੀ ਹੈ ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਸਾਡੇ ਇੰਨਾਂ ਸਟਰੈਸ ਹੈ ਕਿ ਅਸੀਂ ਹੱਸ ਨਹੀਂ ਪਾਉਂਦੇ ਅਤੇ ਇਸੇ ਕਰਕੇ ਇਹੀ ਕਿਤਾਬਾਂ ਪੜ੍ਹੋ ਜਿਹਦੇ ਨਾਲ ਤੁਹਾਨੂੰ ਡਿਪਰੈਸ਼ਨ ਤੁਹਾਡੀ ਦੂਰ ਹੋ ਸਕੇ ਅਤੇ ਤੁਸੀਂ ਹੱਸ ਸਕੋ ਔਰ ਅਤੇ ਨਾਲ ਹੀ ਨਾ ਹੁੰਦੇ ਜਿਹੜੇ ਚੁਟਕਲੇ ਹੈਗੇ ਉਹ ਮੈਨੂੰ ਬੜੇ ਹਾਸੇ ਵਾਲੇ ਲੱਗਦੇ ਹੈ ਉਹ ਇੰਟੈਲੀਜੈਂਸੀ ਵਾਲੇ ਵੀ ਹੁੰਦੇ ਅਸੀਂ ਦੂਸਰਿਆਂ ਨੂੰ ਵੀ ਸੂਜੈਸਟ ਕਰਦੇ ਹੈ ਕਿ ਤੁਸੀਂ ਇਹ ਪੜ੍ਹੋ ਇੱਕ ਤਾਂ ਇਹਦੇ ਨਾਲ ਓ ਖੂਨ ਤੁਹਾਡਾ ਵੱਧਦਾ ਹੈ ਇੱਕ ਤੁਹਾਡਾ ਟਾਈਮ ਪਾਸ ਵੀ ਅੱਛੀ ਤਰ੍ਹਾਂ ਹੋ ਜਾਂਦਾ ਹੈ ਅਤੇ ਇੱਕ ਤੁਸੀਂ ਦੂਸਰਿਆਂ ਨਾਲ ਗੱਲ ਕਰਨ ਯੋਗ ਵੀ ਇੱਕ ਤੁਹਾਡੇ ਕੋਲ ਕੋਈ ਟੋਪਿਕ ਹੁੰਦਾ ਵੈ ਕਿਸੇ ਨੂੰ ਹਸਾਓ ਅਤੇ ਆਪਣਾ ਵੀ ਤੁਹਾਡਾ ਭਲਾ ਹੋਏਗਾ ਅਤੇ ਦੂਸਰੇ ਦਾ ਵੀ ਭਲਾ ਹੋਏਗਾ ਵੈ ਅਤੇ ਇੰਨੀ ਕੁ ਜ਼ਿਆਦਾ ਅੱਜ ਕੱਲ੍ਹ ਜਿੰਨੇ ਵੀ ਡੋਕਟਰ ਹੈਗੇ ਹੈ ਉਹ ਵੀ ਇਹੀ ਸਜੈਸਟ ਕਰਦੇ ਹੈ ਕਿ ਤੁਸੀਂ ਖੁਸ਼ੀ ਵਾਲੇ ਮਾਹੌਲ 'ਚ ਰਹੋ ਡਿਪਰੈਸ਼ਨ ਦੇ ਮਰੀਜ਼ਾਂ ਵਾਲਿਆਂ ਨੂੰ ਸ ਖਾਸ ਕਰਕੇ ਉਹ ਕਹਿੰਦੇ ਕਿ ਤੁਸੀਂ ਖੁਸ਼ੀ ਵਾਲੇ ਮਾਹੌਲ 'ਚ ਰਹੋ ਅਤੇ ਖੁਸ਼ੀ ਵਾਲੇ ਮਾਹੌਲ 'ਚ ਰਵਾਂਗੇ ਕਿਸ ਤਰ੍ਹਾਂ ਜਿਸ ਵੇਲੇ ਤੁਸੀਂ ਹੱਸਣ ਵਾਲੀਆਂ ਚੀਜ਼ਾਂ ਦੇ ਬਾਰੇ ਪੜ੍ਹੋਗੇ ਚੁਟਕਲੇ ਉਹਨਾਂ ਦੇ ਬਾਰੇ ਪੜ੍ਹੋਗੇ ਔਰ ਖੁਸ਼ ਵਾਲੇ ਮਾਹੌਲ 'ਚ ਰਹੋਗੇ ਖੁਸ਼ੀ ਵਾਲਾ ਮਾਹੌਲ ਨਹੀਂ ਮਿਲਦਾ ਤਾਂ ਖੁਸ਼ੀ ਵਾਲੀਆਂ ਕਿਤਾਬਾਂ ਫੜ੍ਹ ਲਉ ਫਿਰ ਉਹ ਪੜ੍ਹ ਲਉ ਚੁਟਕਲੇ ਪੜ੍ਹ ਲਉ ਹੱਸਣਾ ਹੀ ਹੈ ਨਾ ਤੁਸੀਂ ਕਿਸੇ ਵੀ ਤਰੀਕੇ ਨਾਲ ਹੱਸ ਸਕਦੇ ਹੋ ਦੂਸਰਿਆਂ ਦਾ ਟਾਈਮ ਵੀ ਅੱਛਾ ਪਾਸ ਕਰ ਦਿਉ ਆਪਣਾ ਟਾਈਮ ਵੀ ਅੱਛਾ ਪਾਸ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਦੂਸਰੇ ਨੂੰ ਦੁੱਖ ਨਾ ਦਓ ਦੂਸਰਿਆਂ ਨੂੰ ਹਸਾਓ ਚੁਟਕਲੇ ਔਰ ਜੋਲੀ ਮਾਈਂਡਿਡ ਬਣੋ ਤਾਂ ਕਿ ਦੂਸਰਾ ਵੀ ਤੁਹਾਡੇ ਤੋਂ ਕੰਪਨੀ ਤੋਂ ਬੋਰ ਨਾ ਮਹਿਸੂਸ ਕਰੇ ਤੁਹਾਡੀ ਕੰਪਨੀ ਨੂੰ ਇੰਜੋਏ ਕਰੇ ਓਹ ਬੋਰ ਨਾ ਬਿਲਕੁਲ ਮਹਿਸੂਸ ਹੋਵੇ ਤੁਹਾਡੇ ਤੋਂ ਉਹ ਠੀਕ ਹੈ